ਲੋਕਡਾਊਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਘਰ ਪਕਾ ਪਕਾਉਣ ਦੀ ਕੋਸ਼ਿਸ਼ ਕੀਤੀ ਹੈ ਯੂਟਿਊਬ ਤੋਂ ਦੇਖ ਕੇ ਜਿੱਦਾਂ ਕਿ ਪੀਜ਼ਾ ਬਰਗਰ ਨਿਊਡਲ ਪਾਸਤਾ ਕੇਕ ਇਹ ਸਭ ਚੀਜ਼ਾਂ ਮੈਂ ਲੋਕਡਾਊਨ ਵਿੱਚ ਘਰ ਪਕਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਬਣਾਉਣੀਆਂ ਵੀ ਸਿੱਖੀਆਂ ਹਨ